ਮੇਰੀ ਜਿੰਦਗੀ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਕਿ ਮੈਂ ਕ ਕਵਰੇਜ ਵਿੱਚ ਸਨੀ ਸਨੀ ਸੰਨਸਨੀ ਖੇਜ ਜਾਂ ਕਲਿੱਕ ਬਾਟ ਦੀਆਂ ਚਾਲਾਂ ਦੀ ਵਰਤੋਂ ਕੀਤੀ ਹੋਵੇ ਸੋ ਇਸ ਕਰਕੇ ਮੈਂ ਕਦੇ ਵੀ ਇਹਨਾਂ ਦਾ ਕਵਰੇਜ ਨਹੀਂ ਕੀਤਾ